ਪਿਛਲੇ ਮਹੀਨੇ ਹੀ ਮੈਂ ਆਪਣਾ ਦੋਸਤਾਂ ਦੇ ਨਾਲ ਬਾਈਕਿੰਗ ਯਾਤਰਾ ਉੱਤੇ ਜਾ ਕੇ ਆਇਆ ਹਾਂ ਅਸੀਂ ਜਾਣ ਲਈ ਉੱਤਰਾਖੰਡ ਨੂੰ ਇੱਕ ਵਧੀਆ ਲੋਕੇਸ਼ਨ ਚੁਣਿਆ ਜਿਸ ਵਿੱਚ ਅਸੀਂ ਬਹੁਤ ਆਨੰਦ ਮਾਣਿਆ ਜਾਣ ਦੀ ਤਿਆਰੀ ਆਰੰਭ ਕਰਨ ਸਮੇਂ ਸਭ ਤੋਂ ਪਹਿਲਾਂ ਮੈਂ ਆਪਣਾ ਡਰਾਈਵਿੰਗ ਲਾਈਸੈਂਸ ਤੇ ਕੁਝ ਹੋਰ ਬਾਈਕ ਦੇ ਦਸਤਾਵੇਜ਼ ਚੱਕੇ ਆਪਣੀ ਰੇਸਿੰਗ ਬਾਈਕ ਦੀ ਇੱਕ ਵਾਰ ਜਨਜੀ ਤਰ੍ਹਾਂ ਜਾਂਚ ਕਰਵਾਈ ਅਤੇ ਸਰਵਿਸ ਕਰਵਾਈ ਕੇ ਉਸ ਵਿੱਚ ਕੋਈ ਫੋਲਟ ਤਾਂ ਨਹੀਂ ਦੋਨੇ ਟੈਰਾਂ ਦੀ ਹਵਾ ਵੀ ਮੈਂ ਚੈੱਕ ਕਰਵਾਈ ਤੇ ਜੋ ਅਸੈਸਰੀਜ਼ ਸੇਫਟੀ ਅਸੈਸਰੀਜ਼ ਹੁੰਦੀਆਂ ਨੇ ਉਹ ਵੀ ਅਪਣਾਈਆਂ ਮੈਂ ਨਵਾਂ ਹੈਲਮੈਂਟ ਖਰੀਦਿਆ ਆਈ ਐਸ ਆਈ ਮਾਰਕਾ ਵਾਲਾ ਇੱਕ ਲੈਦਰ ਜੈਕਿਟ ਖਰੀਦੀ ਰਬੜ ਦੀ ਜੈਕਟ ਖਰੀਦੀ ਜਿਹੜੀ ਕੀ ਬਾਈਕਰ ਦੀ ਸੇਫਟੀ ਲਈ ਜਰੂਰੀ ਹਨ ਹੋਰ ਵੀ ਕਈ ਚੀਜ਼ਾਂ ਇੱਕ ਬਾਈਕਰ ਦੀ ਸਫੇਟੀ ਲਈ ਜਰੂਰੀ ਹਨ ਉਹ ਵੀ ਚੀਜ਼ਾਂ ਮੈਂ ਖਰੀਦੀਆਂ ਜਿਵੇਂ ਕੀ ਨੀ ਬੈਂਡਸ ਲਏ ਮੈਂ ਕੂਹਣੀਆਂ ਤੇ ਪਾਣ ਵਾਲੇ ਕਵਰ ਲਏ ਹੋਰ ਗੋਡਿਆਂ ਦੇ ਪਾਣ ਵਾਲੇ ਕਵਰ ਲਏ ਜਿਹਨਾਂ ਨਾਲ ਮੈਂ ਸੇਫ ਰਹਾਂ ਤੇ ਸੇਫ ਬਾਈਕਿੰਗ ਦਾ ਐਕਸਪੀਰੀਅੰਸ ਮਾਣ ਸਕਾ ਕਿਉਂਕੀ ਦੁਰਘਟਨਾ ਕਿਸੇ ਵੀ ਸਮੇਂ ਹੋ ਸਕਦੀ ਹੈ ਇੱਕ ਬਾਈਕਰ ਜਾਂ ਡਰਾਈਵਰ ਦੀ ਜਾਨ ਹਮੇਸ਼ਾ ਹਥੇਲੀ ਤੇ ਰਹਿੰਦੀ ਹੈ ਕਿਸੇ ਵੀ ਸਮੇਂ ਕੁਛ ਵੀ ਹੋ ਸਕਦਾ ਮਾੜੀ ਜੀ ਅਣਗਹਿਲੀ ਵੀ ਇੱਕ ਵੱਡੀ ਹਾਦਸਾ ਨੂੰ ਵੱਡੇ ਹਾਦਸੇ ਨੂੰ ਅੰਜਾਮ ਦੇ ਸਕਦੀ ਹੈ ਮੈਂ ਖਾਣ ਪੀਣ ਦੀਆਂ ਕੁਝ ਵਸਤੂਆਂ ਵੀ ਆਪਣੇ ਬੈਗ ਵਿੱਚ ਰੱਖੀਆਂ ਜਿਵੇਂ ਕੀ ਬਿਸਕਿਟ ਵਗੈਰਾ ਨਮਕੀਨ ਤਾਂ ਜੋ ਰਾਹ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਕੋਈ ਸਾਹਮਣਾ ਨਾ ਕਰ ਨਾ ਪੈ ਸਕੇ ਮੈਂ ਹੋਰ ਵੀ ਕਈ ਸਹੂਲਤ ਦਾ ਆਪਣਾ ਸਮਾਨ ਜਿਵੇਂ ਪਾਣੀ ਦੀ ਬੋਤਲ ਹੋਰ ਖਾਣ ਪੀਣ ਦਾ ਕੋਈ ਸਮਾਨ ਵੀ ਬੈਗ ਵਿੱਚ ਨਾਲ ਹੀ ਰੱਖ ਲਿਆ ਜਦੋਂ ਘਰ ਤੋਂ ਅਸੀਂ ਰਵਾਨਾ ਹੋਏ ਤਾਂ ਮੈਂ ਚੈੱਕ ਕੀਤਾ ਕੀ ਕੁਛ ਰਹਿ ਤਾਂ ਨੀ ਗਿਆ ਦੇਖਿਆ ਮੈਂ ਫੋਨ ਦਾ ਪਾਵਰ ਬੈਂਕ ਰਹਿ ਗਿਆ ਸੀ ਮੈਂ ਉਸਨੂੰ ਵੀ ਨਾਲ ਹੀ ਚੱਕ ਲਿਆ ਤਾਂ ਜੋ ਰਾਹ ਵਿੱਚ ਫੋਨ ਦੀ ਬੈਟਰੀ ਲੋਅ ਹੋ ਸਕੇ ਤਾਂ ਮੈਂ ਟੈਮ ਨਾਲ ਫੋਨ ਨੂੰ ਚਾਰਜ ਕਰ ਸਕਾ ਅਸੀਂ ਯੋਜਨਾ ਬਣਾਉਂਦੇ ਸਮੇਂ ਤੋਂ ਹੀ ਪਹਿਲਾਂ ਈ ਤਿਆਰੀ ਕਰ ਲਈ ਸੀ ਮੈਂ ਬਾਕੀ ਦੋਸਤਾਂ ਨੂੰ ਵੀ ਦੱਸ ਦਿੱਤਾ ਸੀ ਵੀ ਇਹ ਇਹ ਜਿਹਰੀ ਚੀਜ਼ਾਂ ਤੁਸੀਂ ਜਰੂਰਤ ਅਨੁਸਾਰ ਲੈ ਕੇ ਆਉਣੀਆਂ ਹਨ ਤਾਂ ਜੋ ਸਾਡੇ ਕੋਲ ਵਾਧੂ ਵੇਟ ਵੀ ਨਾ ਹੋਵੇ ਅਤੇ ਅਸੀਂ ਸਫਰ ਦਾ ਆਨੰਦ ਮਾਣ ਸਕੀਏ ਸਾਡੀ ਯੋਜਨਾ ਪਿਛਲੇ ਦੋ ਮਹੀਨਿਆਂ ਤੋਂ ਬਣ ਰਹੀ ਸੀ ਇਸ ਯਾਤਰਾ ਤੇ ਜਾਣ ਦੀ ਪ੍ਰੰਤੂ ਸਫਲ ਹੀ ਨਹੀਂ ਸੀ ਹੋ ਰਹੀ ਫੇਰ ਚਲੋ ਇਸ ਪਿਛਲੇ ਮਹੀਨੇ ਸਾਡੀ ਸਫਲਾ ਯਾਤਰਾ ਸਫਲ ਹੋਈ ਅਸੀਂ ਜਾ ਕੇ ਆਏ ਅਸੀਂ ਕਈ ਥਾਵਾਂ ਤੇ ਘੁੰਮੇ ਬਾਈਕਿੰਗ ਦਾ ਐਕਸਪੀਰੀਅੰਸ ਦੇਖਿਆ ਜਿਵੇਂ ਕੀ ਟੀਮ ਵਰਕ ਨਸੈਸਰੀ ਐ ਸਾਨੂੰ ਪਤਾ ਲੱਗਿਆ ਇਸ ਵਿੱਚ ਜਦੋਂ ਕੋਈ ਬਾਈਕਰ ਪਿੱਛੇ ਰਹਿ ਜਾਂਦਾ ਸੀ ਤਾਂ ਅਸੀਂ ਅੱਗੇ ਰੁਕ ਕੇ ਉਸਦੀ ਵੇਟ ਕਰਦੇ ਸੀ ਅਸੀਂ ਇਕੱਠੇ ਖਾਣਾ ਪੀਣਾ ਢਾਬਿਆਂ ਤੇ ਰੁਕ ਕੇ ਇਕੱਠੇ ਇੱਕ ਦੂਜੇ ਦੀ ਸਹਾਇਤਾ ਦੇਣਾ ਫਸਟ ਏਡ ਕਿੱਟ ਵੀ ਅਸੀਂ ਨਾਲ ਈ ਰੱਖ ਲਈ ਸੀ ਤਾਂ ਜੋ ਰਾਹ ਵਿੱਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈ ਸਕੇ ਸਗੋਂ ਸਾਡੇ ਨਾਲ ਦੇ ਇੱਕ ਬਾਈਕਰ ਨੂੰ ਤੇਜ਼ ਧੁੱਪ ਦੇ ਕਾਰਨ ਬੁਖਾਰ ਵੀ ਹੋ ਗਿਆ ਸੀ ਜਿਸ ਕਰਕੇ ਸਾਨੂੰ ਇੱਕ ਦਿਨ ਕਿਸੇ ਜਗ੍ਹਾ ਸਟੇਅ ਕਰਨਾ ਪਿਆ ਅਤੇ ਉਸਦੀ ਦੇਖਭਾਲ ਕਰਨੀ ਪਈ ਪ੍ਰੰਤੂ ਸਾਡੇ ਕੋਲ ਫਸਟਏਡ ਦੀਆਂ ਸੁਵਿਧਾਵਾਂ ਹੋਣ ਕਰਕੇ ਸਾਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਦੂਜੇ ਦਿਨ ਈ ਉਹ ਉਪਲੱਬਧ ਸਹੀ ਹੋ ਗਿਆ ਸਹੀ ਸਲਾਮਤ ਹੋਗਿਆ ਤੇ ਅਸੀਂ ਦੁਆਰਾ ਤੋਂ ਰਵਾਨਗੀ ਕਰ ਗਏ ਇਸ ਯਾਤਰਾ ਵਿੱਚ ਕਈ ਨਵੇਂ ਦੋਸਤ ਵੀ ਬਣੇ ਤੇ ਪੁਰਾਣੇ ਦੋਸਤਾਂ ਨਾਲ ਵੀ ਸਾਂਝ ਵਧੀ